ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਸਾਡੀ ਅਕੈਡਮੀ ਕੱਪੜੇ ਹੈਗੀ ਹੈ ਦੱਸੋ ਹਾਂਜੀ ਹਾਂਜੀ ਸਾਰਾ ਕੁਛ ਹਾਂਜੀ ਸਾਰਾ ਕੁਛ ਹੈਗਾ ਬੇਟਾ ਰਹਿਣ ਦਾ ਪ੍ਰਬੰਧ ਸਭ ਕੁਛ ਹੈਗਾ ਅਤੇ ਤੁਸੀਂ ਦੱਸੋ ਹਾਂਜੀ ਕਿਹੜੀ ਗੇਮ ਓਕੇ ਪਹਿਲਾਂ ਤੁਸੀਂ ਖੇਡੇ ਹੋ ਅੱਛਾ ਜੀ ਅਤੇ ਹੋਰ ਤੁਹਾਡਾ ਇੰਟਰਸਟ ਹੋਰ ਕਿਹੜੀ ਕਿਹੜੀ ਗੇਮ 'ਚ ਆ ਓਕੇ ਠੀਕ ਹੈ ਅਤੇ ਆਪਣੇ ਹਾਂਜੀ ਅਤੇ ਆਪਣੇ ਆਪਣੇ ਬੇਟਾ ਹਰ ਇੱਕ ਤਰ੍ਹਾਂ ਦੀਆਂ ਉਰੇ ਮਤਲਬ ਵੀ ਖੇਡਾਂ ਕਰਵਾਈਆਂ ਜਾਂਦੀਆਂ ਨੇ ਜਿਵੇਂ ਵੋਲੀਬੋਲ ਕਹਿੰਦੇ ਹੋ ਤੁਸੀਂ ਬਸਕਿੱਟਬੋਲ ਕ੍ਰਿਕੇਟ ਖੋ ਖੋ ਕਬੱਡੀ ਹਰ ਇੱਕ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਨੇ ਤਾਂ ਤੁਸੀਂ ਹਾਂਜੀ ਅਤੇ ਤੁਸੀਂ ਕਿਹੜੀ ਗੇਮ 'ਚ ਜ਼ਿਆਦਾ ਇੰਟਰਸਟ ਰੱਖਦੇ ਹੋ ਠੀਕ ਹੈ ਅਤੇ ਆਪਣੇ ਮਤਲਬ ਵੀ ਹੋਰ ਬਹੁਤ ਬਰਾਂਚਾਂ ਨੇ ਅਕੈਡਮੀ ਦੀਆਂ ਹਾਂਜੀ ਅਤੇ ਉੱਚੇ ਲੈਵਲ 'ਤੇ ਵੀ ਮਤਲਬ ਵੀ ਖੇਡਾਂ ਕਰਵਾਈਆਂ ਜਾਂਦੀਆਂ ਨੇ ਹਾਂ ਜਿਵੇਂ ਹੁਣ ਤੁਸੀਂ ਪਹਿਲਾਂ ਤੁਸੀਂ ਕਿਤੇ ਖੇਡੇ ਹੋ ਜਿਵੇਂ ਉਸ ਹਿਸਾਬ ਨਾਲ ਫਿਰ ਤੁਹਾਨੂੰ ਉੱਚੇ ਲੈਵਲ 'ਤੇ ਵੀ ਮਤਲਬ ਵੀ ਖਿਡਾਇਆ ਜਾਊਗਾ ਜੇ ਤੁਸੀਂ ਪਹਿਲੀ ਵਾਰ ਖੇਡ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਕੋਚਿੰਗ ਦਿੱਤੀ ਜਾਊਗੀ ਉਸ ਤੋਂ ਬਾਅਦ ਫਿਰ ਤੁਹਾਨੂੰ ਉੱਚੇ ਲੈਵਲ 'ਤੇ ਖਿਡਾਇਆ ਜਾਊਗਾ ਅਤੇ ਹਾਂ ਅਤੇ ਮਤਲਬ ਵੀ ਜੋ ਵੀ ਜਿਵੇਂ ਵੀ ਤੁਹਾਨੂੰ ਐਂਏ ਲੱਗਦਾ ਵੀ ਅਸੀਂ ਨੇ ਗੇਮ ਸਿੱਖਣੀ ਆ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਗੇਮ ਸਿਖਾਈ ਜਾਊਗੀ ਹਰ ਇੱਕ ਤਰ੍ਹਾ ਦੀ ਗੇਮ ਦੀ ਪ੍ਰੈਕਟਿਸ ਕਰਵਾਈ ਜਾਊਗੀ

ਹਾਂਜੀ ਰਹਿਣ ਸਹਿਣ ਦਾ ਵੀ ਸਾਰਾ ਪ੍ਰਬੰਧ ਹੈ ਖਾਣ ਪੀਣ ਦਾ ਸਾਰਾ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੈ ਜਿਵੇਂ ਹੁਣ ਆਪਣੇ ਹਾਂ ਜਿਵੇਂ ਹੁਣ ਆਪਣੇ ਵੱਡੇ ਲੈਵਲ 'ਤੇ ਮਤਲਬ ਖਿਡਾਰੀ ਖੇਡਦੇ ਨੇ ਕਈ ਵਾਰ ਖੇਡਦਿਆਂ ਤੋਂ ਉਹਨਾਂ ਦੇ ਸੱਟ ਵੱਜਦੀ ਹੈ ਤਾਂ ਮੈਡੀਸਨ ਦਾ ਵੀ ਹਰ ਇਕ ਤਰ੍ਹਾਂ ਦਾ ਉਰੇ ਪ੍ਰਬੰਧ ਹੈ ਹਰ ਇੱਕ ਹਰ ਇਕ ਲੈਵਲ ਦੀ ਹਰ ਇੱਕ ਚੀਜ਼ ਇੱਥੇ ਤੁਹਾਨੂੰ ਗੇਮ ਸਾਰਾ ਕੁਛ ਹਾਈ ਲੈਵਲ 'ਤੇ ਮਿਲੂਗਾ ਤਾਂ ਤੁਸੀਂ ਕੋਈ ਹਾਂ ਤੁਸੀਂ ਕੋਈ ਗੱਲ ਨਹੀਂ ਤੁਸੀਂ ਆ ਜਾਇਓ ਆ ਕੇ ਤੁਸੀਂ ਮਤਲਬ ਵੀ ਕੋਚਿੰਗ ਲਿਓ ਦੇਖਿਓ ਜਿਵੇਂ ਤੁਹਾਨੂੰ ਕਿੱਦਾਂ ਦਾ ਮਾਹੌਲ ਲੱਗ ਰਿਹਾ ਇੱਕ ਵਾਰ ਤੁਸੀਂ ਜ਼ਰੂਰ ਆਇਓ ਹਾਂਜੀ

ਫੀਸ ਕੋਈ ਗੱਲ ਨਹੀਂ ਫੀਸ ਤਾਂ ਫਿਰ ਆਪਾਂ ਗੱਲ ਕਰ ਲਾਂਗੇ ਤੁਸੀਂ ਆਇਓ ਆ ਕੇ ਤੁਸੀਂ ਇੱਕ ਵਾਰ ਦੇਖਿਓ ਬਾਕੀ ਤਾਂ ਸਾਡੀ ਮਹੀਨੇ ਦੀ ਹਾਂ ਬਾਕੀ ਤਾਂ ਸਾਡੀ ਮਹੀਨੇ ਦੀ ਅਸੀਂ ਮਤਲਬ ਵੀ ਦੋ ਹਜ਼ਾਰ ਪੰਦਰਾਂ ਸੌ ਤੱਕ ਲੈਂਦੇ ਹਾਂ ਬਾਕੀ ਜਿੱਦਾਂ ਜਿੱਦਾਂ ਦੇ ਮਤਲਬ ਵੀ ਗੇਮ ਹੈ ਉਸ ਹਿਸਾਬ ਨਾਲ ਫਿਰ ਆਪਣੀ ਫੀਸ ਹੈ ਠੀਕ ਠੀਕ ਹੈ ਓਕੇ ਬਾਏ